ਕੀ ਤੁਹਾਡੀ ਰੋਜ਼ੀ ਰੋਟੀ ਬਿਜਲੀ 'ਤੇ ਨਿਰਭਰ ਕਰਦੀ ਹੈ ਹਾਂ ਕਿਉਂਕਿ ਅੱਜ ਕੱਲ੍ਹ ਇੰਡਕਸ਼ਨ ਚੱਲ ਪਏ ਹਨ ਇੰਡਕਸ਼ਨ ਦਾ ਬਹੁਤ ਹੀ ਜ਼ਿਆਦਾ ਫ਼ਾਇਦਾ ਕਿਉਂਕਿ ਇਹਦੇ ਉੱਤੇ ਮਤਲਬ ਬਰਤਨ ਕਾਲੇ ਨਹੀਂ ਹੁੰਦੇ ਅਤੇ ਬਿਜਲੀ ਦੇ ਕੱਟ ਦੌਰਾਨ ਸਾਨੂੰ ਪ੍ਰੋਬਲਮ ਕਾਫ਼ੀ ਹੋ ਜਾਂਦੀ ਹੈ ਕਿਉਂਕਿ ਇਹਦੇ ਦਰਮਿਆਨ ਸਾਨੂੰ ਗੈਸ ਚੁੱਲ੍ਹਾ ਵਗੈਰਾ ਵੀ ਰੱਖਣਾ ਪੈਂਦਾ ਉਹਦੇ 'ਤੇ ਫਿਰ ਮਤਲਬ ਰੋਟੀ ਵਗੈਰਾ ਬਣਾ ਸਕਦੇ ਹਾਂ ਇਹ ਰੋਸ਼ਨੀ ਵਾਸਤੇ ਸਾਡੇ ਕੋਲ ਇਨਵਰਟਰ ਅੱਜ ਕੱਲ੍ਹ ਸਾਰੇ ਘਰਾਂ ਵਿੱਚ ਮੌਜੂਦ ਹਨ ਤਾਂ ਉਹਦੇ ਨਾਲ ਮਤਲਬ ਸਾਨੂੰ ਕਾਫ਼ੀ ਮਤਲਬ ਸਹੂਲਤ ਮਿਲ ਜਾਂਦੀ ਆ ਉਹਦੇ ਨਾਲ ਆਪਣਾ ਲਾਈਟ ਵਗੈਰਾ ਮਤਲਬ ਸਭ ਕੁਛ ਆਨ ਹੋ ਸਕਦਾ ਹੈ